ਸ਼ਹੀਦ ਭਾਈ ਭਗਤ ਸਿੰਘ ਜਿਨ੍ਹਾਂ ਦਾ ਜਨਮ ਉੱਨੀ ਸੌ ਸੱਤ ਵਿੱਚ ਹੋਇਆ ਉਹਨਾਂ ਨੇ ਜੇਲ੍ਹ ਅੰਦਰ ਰਹਿੰਦਿਆਂ ਬਹੁਤ ਲੜਾਈਆਂ ਲੜੀਆਂ ਜਿਵੇਂ ਕਿ ਅੰਗਰੇਜ਼ਾਂ ਤੋਂ ਆਪਣੇ ਕੈਦੀ ਭਾਈਆਂ ਲਈ ਹੱਕ ਮੰਗਣ ਦੀਆਂ ਅਤੇ ਉਹਨਾਂ ਨੂੰ ਵਧੀਆ ਕਿਤਾਬਾਂ ਮਿਲ ਸਕੇ ਪੜ੍ਹਨ ਲਈ ਨਿਊਜ਼ ਪੇਪਰ ਮਿਲ ਸਕੇ ਅਤੇ ਜੋ ਅੰਦਰ ਕੈਦੀ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੀ ਪੂਰੀ ਦਿਹਾੜੀ ਮਿਲ ਸਕੇ ਪੂਰੇ ਪੈਸੇ ਮਿਲ ਸਕਣ ਅਤੇ ਰੋਟੀ ਪਾਣੀ ਵਧੀਆ ਮਿਲ ਸਕੇ ਜਿਸ ਲਈ ਉਹਨਾਂ ਨੇ ਅੰਦਰ ਭੁੱਖ ਹੜਤਾਲ ਵੀ ਰੱਖੀ ਸੀ ਫਿਰ ਉਹਨਾਂ ਦਾ ਸਾਰਿਆਂ ਨਾਲ਼ੋਂ ਵੱਡਾ ਯੋਗਦਾਨ ਸੀ ਜੋ ਉਹ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸੀ ਉਹਨਾਂ ਨੇ ਅੰਗਰੇਜ਼ਾਂ ਨਾਲ ਲੜਾਈਆਂ ਵੀ ਕੀਤੀਆਂ ਸੀ ਅਤੇ ਸਾਡੇ ਜਿੰਨੇ ਵੀ ਨਵੇਂ ਯੂਥ ਦੇ ਮੁੰਡੇ ਸੀ ਉਹਨਾਂ ਦਾ ਇੱਕ ਇਕੱਠ ਬਣਾ ਕੇ ਸਾਰਿਆਂ ਨੂੰ ਸਹੀ ਰਾਹ 'ਤੇ ਪਾਇਆ ਸੀ ਅਤੇ ਉਹਨਾਂ ਦੇ ਨਾਲ਼ ਰਾਜਦੇਵ ਸੁਖਦੇਵ ਰਾਜਗੁਰੂ ਅਤੇ ਸੁਖਦੇਵ ਵੀ ਸਨ ਜੋ ਉਹਦੇ ਸਾਥੀ ਸੀ ਉਹਨਾਂ ਤਿੰਨਾਂ ਨੇ ਰਲ਼ ਕੇ ਸਾਡੇ ਭਾਰਤ ਦੇਸ਼ ਨੂੰ ਬਹੁਤ ਜਿਆਦਾ ਡਿਵੈਲਪ ਕੀਤਾ ਔਰ ਸਮਝਾਇਆ ਅਤੇ ਸਾਡੇ ਹੱਕਾਂ ਵਾਸਤੇ ਜਾਗਰੂਕ ਕਰਾਇਆ ਜੀਂਦੇ ਰਹਿੰਦਿਆਂ ਉਹਨਾਂ ਨੂੰ ਬਾਅਦ ਵਿਚ ਫਾਂਸੀ ਦਾ ਰੱਸਾ ਚੁੰਮਣਾ ਪਿਆ